ਮੈਂ ਆਪਣੇ ਪਰਿਵਾਰ ਦੇ ਨਾਲ ਯਾਤਰਾ ਕਰਨ ਲਈ ਗਈ ਸੀ ਤਾਂ ਉੱਥੇ ਮੈਂ ਕਾਫੀ ਇਲਾਕੇ ਵੱਖ ਵੱਖ ਇਲਾਕੇ ਦੇ ਲੋਕਾਂ ਨੂੰ ਦੇਖਿਆ ਜਿਸ ਨਾਲ ਮੈਨੂੰ ਪਤਾ ਲੱਗਿਆ ਕਿ ਉਹ ਕਿਵੇਂ ਵਿਲੱਖਣ ਨੇ ਸਾਡੇ ਤੋਂ ਅਤੇ ਉਹਨਾਂ ਦੇ ਕੱਪੜਿਆਂ ਦਾ ਢੰਗ ਖਾਣ ਪੀਣ ਦਾ ਢੰਗ ਅਤੇ ਬੋਲਣ ਦਾ ਢੰਗ ਵੀ ਕਾਫੀ ਅਲੱਗ ਸੀ ਜਿਸ ਨਾਲ ਮੈਨੂੰ ਉਹਨਾਂ ਦੀ ਵਿਲੱਖਣਤਾ ਦਾ ਪਤਾ ਲੱਗਿਆ ਅਤੇ ਮੈਨੂੰ ਪਤਾ ਲੱਗਿਆ ਕਿ ਸਾਡਾ ਜਿਹੜਾ ਇਲਾਕਾ ਹੈ ਉਹ ਕਿਵੇਂ ਦਾ ਹੈ ਅਤੇ ਇਹ ਅਨੁਭਵ ਦੇ ਨਾਲ ਮੈਨੂੰ ਇਹ ਵੀ ਅਨੁਭਵ ਹੋਇਆ ਕਿ ਸਾਨੂੰ ਭਾਈਚਾਰੇ ਦੀ ਭਾਵਨਾ ਹਮੇਸ਼ਾ ਵਧਾਉਣੀ ਚਾਹੀਦੀ ਜਦੋਂ ਅਸੀਂ ਕਿਤੇ ਘੁੰਮਣ ਲਈ ਜਾਂਦੇ ਹਾਂ ਸਾਨੂੰ ਵੱਖ ਵੱਖ ਧਰਮਾਂ ਦਾ ਪਤਾ ਲੱਗਦਾ ਉਹਨਾਂ ਦੀ ਸੰਸਕ੍ਰਿਤੀਆਂ ਦਾ ਪਤਾ ਲੱਗਦਾ ਅਤੇ ਉਹਨਾਂ ਦੇ ਰਹਿਣ ਸਹਿਣ ਅਤੇ ਉਹਨਾਂ ਦੀ ਬੋਲੀ ਦਾ ਵੀ ਪਤਾ ਲੱਗਦਾ ਹੈ ਜਿਸ ਨਾਲ ਸਾਨੂੰ ਕਾਫੀ ਅਨੁਭਵ ਹੁੰਦਾ ਹੈ ਅਤੇ ਉਹ ਅਸੀਂ ਵਰਤ ਵੀ ਸਕਦੇ ਹਾਂ ਜਦੋਂ ਅਸੀਂ ਕਿਤੇ ਫਸ ਜਾਈਏ ਸਾਨੂੰ ਕਿਸੇ ਦੀ ਲੋੜ ਹੋਵੇ ਤਾਂ ਇਹਨਾਂ ਤਰੀਕਾਂ ਦਾ ਇਸਤੇਮਾਲ ਕਰ ਸਕਦੇ ਹਾਂ ਅਤੇ ਭਾਈਚਾਰੇ ਦੀ ਭਾਵਨਾ ਵਧਾਉਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਸਾਨੂੰ ਜਦੋਂ ਅਸੀਂ ਕਿਤੇ ਘੁੰਮਣ ਲਈ ਜਾਂਦੇ ਹਾਂ ਤਾਂ ਕਈ ਵਾਰੀ ਕਿਸੇ ਨਾਲ ਰਹਿਣਾ ਵੀ ਪੈ ਸਕਦਾ ਆ ਅਤੇ ਉਹ ਉਹਨਾਂ ਨਾਲ ਸਾਨੂੰ ਘੁੰਮਣਾ ਵੀ ਪੈ ਸਕਦਾ ਆ ਅਤੇ ਸਾਨੂੰ ਭਾਈਚਾਰੇ ਦੀ ਭਾਵਨਾ ਕਿ ਸਾਡੇ ਵਿੱਚ ਹੋਵੇ ਤਾਂ ਅਸੀਂ ਉਹਨਾਂ ਨਾਲ ਆਰਾਮ ਨਾਲ ਰਹਿ ਸਕਦੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਹਨਾਂ ਦੀ ਹੈਲਪ ਵੀ ਕਰ ਸਕਦੇ ਹਾਂ ਅਤੇ ਉਹ ਵੀ ਸਾਡੀ ਕਰ ਸਕਦੇ ਨੇ ਇਸ ਕਰਕੇ ਸਾਨੂੰ ਭਾਈਚਾਰੇ ਦੀ ਭਾਵਨਾ ਵੀ ਵਧਾਉਣੀ ਚਾਹੀਦੀ ਹੈ